ਪੇਂਡੂ ਨੂੰ ਖੇਤੀਬਾੜੀ ਵਿੱਚ ਹੋਣਹਾਰ ਕਿਰਤੀਆਂ ਨੂੰ ਲੱਭਣਾ ਬਹੁਤ ਹੀ ਔਖਾ ਹੋਇਆ ਵਾ ਕਿੱਦਾਂ ਕਿ ਵੀ ਅੱਜ ਕੱਲ੍ਹ ਕੋਈ ਹੁਨਰ ਹਾਰ ਕਿਰਤੀਆਂ ਕਰਕੇ ਖੁਸ਼ ਨਹੀਂ ਆ ਉਹ ਕਿਰਤੀ ਜਿਹੜਾ ਵੀ ਸਾਰੀ ਹੀ ਖੇਤੀ ਕਰਦਾ ਹੋਵੇ ਉਸਨੂੰ ਲੱਭਣਾ ਬਹੁਤ ਹੀ ਔਖਾ ਵਾ ਉਹਨੂੰ ਉਹ ਫਿਰ ਆਪਣੀਆਂ ਡਮ ਮਤਲਬ ਕਿ ਆਪਣੇ ਮੂੰਹ ਮੰਗੇ ਪੈਸੇ ਰੱਖਦਾ ਵਾ ਉਹਨੂੰ ਫਿਰ ਉੰਨੇ ਹੀ ਪੈਸੇ ਦੇਣੇ ਪੈਂਦੇ ਆ ਖਾਣ ਪੀਣ ਦੀਆਂ ਦੀਆਂ ਵਸਤਾਂ ਦੱਸਦਾ ਫਿਰ ਉਹਨੂੰ ਉਹ ਹੀ ਚੀਜ਼ਾਂ ਹੀ ਦੇਣੀਆਂ ਪੈਂਦੀਆਂ ਹਨ ਜਿਵੇਂ ਕਿ ਕੱਪੜਾ ਰੋਟੀ ਲੱਸੀ ਦਹੀਂ ਜਿੱਦਾਂ ਹਰੇਕ ਚੀਜ਼ ਦੀ ਉਹਨੇ ਡਿਮਾਂਡ ਕਰਨੀ ਪੈਂਦੀ ਆ ਜਿੱਦਾਂ ਉਹ ਜਿਹੜੇ ਹਿਸਾਬ ਨਾਲ ਤਨਖਾਹ ਮੰਗਦਾ ਫਿਰ ਉਸੇ ਨੂੰ ਹੀ ਤਨਖਾਹ ਦੇਣੀ ਪੈਂਦੀ ਆ ਅਤੇ ਹੋਣਹਾਰ ਕਿਰਤੀ ਉਹ ਆ ਜਿਹੜਾ ਮਤਲਬ ਕਿ ਸਾਰੀ ਖੇਤੀ ਜਿੱਦਾਂ ਵੀ ਉਹ ਆਪੇ ਹੀ ਸਾਰਾ ਕੰਮ ਸਾਂਭੇ ਉਹਨੂੰ ਵਡਾਵੇਂ ਖੇ ਉਹਨੂੰ ਬੀਜੇ ਉਹਦੀ ਮਤਲਬ ਕਿ ਕੇਅਰ ਕਰੇ ਉਹਨੂੰ ਸਮੇਂ ਸਮੇਂ ਸਿਰ ਖਾਦਾਂ ਪਾਵੇ ਸਮੇਂ ਸਿਰ ਹੀ ਉਹ ਮਤਲਬ ਕਿ ਹਰੇਕ ਕੰਮ ਨੂੰ ਆਪਣੇ ਸਮੇਂ ਸਿਰ ਹੀ ਕਰੇ ਉਹ ਹੋਣਹਾਰ ਕਿਰਤੀ ਲੱਭਣਾ ਬਹੁਤ ਹੀ ਔਖਾ ਵਾ ਮਤਲਬ ਉਹਨੂੰ ਫਿਰ ਮੂੰਹ ਮੰਗੇ ਪੈਸੇ ਵੀ ਦੇਣੇ ਪੈਂਦੇ ਆ ਜਿਵੇਂ ਤਨਖਾਹ ਉਹਦੀ ਚਾਰ ਸੌ ਰੁਪਇਆ ਇੱਕ ਦਿਨ ਦਾ ਤਾਂ ਦਿਹਾੜੀ ਆ ਉਹਦੇ ਹਿਸਾਬ ਨਾਲ ਫਿਰ ਉਹਨੂੰ ਮਹੀਨੇ ਦੀ ਤਨਖਾਹ ਵੀ ਦਿੱਤੀ ਜਾਂਦੀ ਹੈ ਜਾਂ ਮੰਥ ਇਹ ਛੇਆਂ ਮਹੀਨਿਆਂ ਦੀ ਜਾਂ ਸਾਲ ਦੀ ਤਨਖਾਹ ਦਿੱਤੀ ਜਾਂਦੀ ਆ ਅਤੇ ਅੱਜ ਕੱਲ੍ਹ ਉਹ ਦਿਹਾੜੀ ਕਾਮੇ ਨੂੰ ਮੌਜੂਦਾ ਉਹਦੇ ਮੂੰਹ ਮੰਗੀ ਹੀ ਤਨਖਾਹ ਦਿੱਤੀ ਜਾਂਦੀ ਆ